ਪੰਜਾਬੀ ਭਾਸ਼ਾ ਵਿੱਚ ਬਹੁਤ ਸਾਰੇ ਸ਼ਬਦ ਜੋ ਕਿ ਦਿਲਚਸਪ ਅਤੇ ਸਧਾਰਨ ਹਨ ਪਰ ਇੱਕ ਸ਼ਬਦ ਜਿਵੇਂ ਕਿ ਵੱਟ ਇਹਦੇ ਅਲੱਗ ਅਲੱਗ ਅਰਥ ਨੇ ਅਤੇ ਅਲੱਗ ਅਲੱਗ ਜਗ੍ਹਾ ਇਹਨੂੰ ਵਰਤਿਆ ਜਾ ਸਕਦਾ ਹੈ ਜਿਵੇਂ ਉਹ ਵੱਟ ਵੱਟ ਤੁਰਿਆ ਜਾ ਰਿਹਾ ਹੈ ਉਹ ਮੈਨੂੰ ਦੇਖ ਕੇ ਆਪਣੀਆਂ ਮੁੱਛਾਂ ਨੂੰ ਵੱਟ ਚਾੜ੍ਹ ਰਿਹਾ ਹੈ ਜਿਵੇਂ ਮੌਸਮ ਵਿੱਚ ਅੱਜ ਬਹੁਤ ਵੱਟ ਹੈ ਇਹ ਕੱਪੜੇ ਦੇ ਵੱਟ ਪ੍ਰੈੱਸ ਨਾਲ ਠੀਕ ਕ ਕਰੋ ਅਜਿਹੇ ਸ਼ਬਦ ਬਹੁਤ ਸਾਰੇ ਹੋਰ ਵੀ ਹਨ ਪਰ ਇਹ ਸ਼ਬਦ ਵੱਟ ਦੇ ਕਿੰਨੇ ਹੀ ਅਰਥ ਹੋਰ ਵੀ ਨਿਕਲ ਸਕਦੇ ਹਨ